ਹਾਂਜੀ ਸਤਿ ਸ਼੍ਰੀ ਅਕਾਲ ਜੀ ਸਿਹਤ ਸੰਭਾਲ ਪ੍ਰਣਾਲੀ ਇਹਨੂੰ ਐੱਨ ਆਰ ਆਈ ਲੋਕ ਵੀ ਫੰਡ ਭੇਜਦੇ ਹਨ ਸੈਂਟਰ ਸਰਕਾਰਾਂ ਸਰਕਾਰ ਮਿਲ ਕੇ ਵੀ ਇਹਨਾਂ ਨੂੰ ਫੰਡ ਦਿੰਦੇ ਹਨ ਜਿਹੜੇ ਆਸ਼ਰਮ ਵਗੈਰਾ 'ਚ ਹੁੰਦਿਆ ਹੁੰਦੇ ਹਨ ਉਨ੍ਹਾਂ ਲਈ ਵੀ ਇਹ ਫੰਡ ਦਿੱਤਾ ਜਾਂਦਾ ਹੈ ਕਮੇ ਲੋਕ ਜਿਹੜੀ ਕਮੇਟੀ ਬਣਾ ਕੇ ਵੀ ਇਨ੍ਹਾਂ ਦੀ ਮਦਦ ਕਰਦੇ ਹਨ ਇਨ੍ਹਾਂ ਨੂੰ ਫੰਡ ਦਿੰਦੇ ਹਨ ਸਰਕਾਰ ਵਲੋਂ ਵੀ ਬਹੁਤ ਸਾਰੇ ਉਪਰਾਲੇ ਕੀਤੇ ਗਏ ਹਨ ਸਰਕਾਰ ਵੀ ਇਨ੍ਹਾਂ ਨੂੰ ਬਹੁਤ ਸਾਰਾ ਫੰਡ ਦਿੰਦੀ ਹੈ ਇਨ੍ਹਾਂ ਦੀ ਮਦਦ ਕਰਦੀ ਹੈ ਸਿਹਤ ਸੰਭਾਲ ਲਈ ਲਈ ਲੋਕਾਂ ਲਈ ਬਹੁਤ ਹੀ ਜਿਆਦਾ ਪਰ ਬਹੁਤ ਜਿਆਦਾ ਫੰਡ ਕੱਠਾ ਕੀਤਾ ਜਾਂਦਾ ਹੈ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਉਨ੍ਹਾਂ ਨੂੰ ਉਨ੍ਹਾਂ ਨੂੰ ਫ੍ਰੀ ਦਵਾਈਆਂ ਆਦੀ ਦਿੱਤੀਆਂ ਜਾਂਦੀਆਂ ਹਨ ਤੇ ਕਮੇਟੀ ਬਣਾ ਕੇ ਵੀ ਉਨ੍ਹਾਂ ਨੂੰ ਫੰਡ ਦਿੱਤਾ ਜਾਂਦਾ ਹੈ